ਹੈਲੋ ਹਾਂਜੀ ਸਰ ਹਾਂਜੀ ਸਰ ਅੱਛਾ ਸਰ ਠੀਕ ਐ ਸਰ ਠੀਕ ਐ ਠੀਕ ਐ ਸਰ ਤੇ ਸਰ ਜਿਵੇਂ ਮੈਂ ਸਵੇਰੇ ਤੇ ਮਤਲਬ ਅੱਠ ਵਜੇ ਆਨੀ ਆ ਤੇ ਮੇਰਾ ਦੋ ਵਜੇ ਤੱਕ ਟਾਈਮ ਰਹਿੰਦਾ ਤੁਹਾਡੇ ਘਰ ਉਸ ਤੋਂ ਬਾਅਦ ਫਿਰ ਮੈਨੂੰ ਦੋ ਵਜੇ ਤੋਂ ਬਾਅਦ ਫਿਰ ਮੈਂ ਘਰ ਨੀ ਜਾਵਾਗੀ

ਤੇ ਸਰ ਮੈਨੂੰ ਐਸਾ ਐਕਸਟਰਾ ਪੈਸੇ ਦੇ ਸਰ ਮੈਨੂੰ ਮਿਲਣਗੇ ਸਰ ਠੀਕ ਐ ਸਰ ਜੀ ਤੇ ਸਰ ਮੈਨੂੰ ਵੀ ਛੱਡਣ ਕੌਣ ਜਾਊਗਾ ਮੈਂ ਕੱਲੀ ਕਿੱਦਾਂ ਜਾਵਾਂਗੀ ਕਿਉਂਕਿ ਮੇਰਾ ਮੇਰੇ ਘਰ ਮੇਰਾ ਬੇਟਾ ਜਿਹੜਾ ਹੈਗਾ ਉਹ ਤੇ ਉਹ ਵੀ ਕੰਮ ਤੇ ਜਾਂਦਾ ਨਾ ਤੇ ਮੈਨੂੰ ਲੈਣ ਕੌਣ ਆਉਗਾ

ਠੀਕ ਠੀਕ ਠੀਕ ਐ ਸਰ ਮੈਂ ਉਹਨਾਂ ਨਾਲ ਗੱਲ ਕਰ ਲੈਣੀ ਤਾਂ ਸਰ ਮੈਨੂੰ ਫਿਰ ਦੱਸ ਦੋ ਕਿ ਕੱਲ ਬਣਾਣਾ ਕੀ ਆ ਕੀ ਕੀ ਬਣਾਉਣਾ ਠੀਕ ਐ ਸਰ

ਠੀਕ ਐ ਸਰ ਤੇ ਸਰ ਮੈਨੂੰ ਮੈਨੂੰ ਲੱਗਦਾ ਕਿ ਥੋੜਾ ਮੈਨੂੰ ਹੋਰ ਉਤੋਂ ਇਕ ਦਿਨ ਪਹਿਲਾ ਹੋਰ ਆਉਣਾ ਪੈਣਾ ਕਿਉਂਕੀ ਫਿਰ ਮੈਂ ਆਹ ਜਿਹੜੇ ਚਨੇ ਚੁਨੇ ਭੇਣੇ ਪੈਣੇ ਆ ਪਹਿਲਾਂ ਕੋਈ ਗੱਲ ਨੀ ਸਰ ਠੀਕ ਠੀਕ ਐ ਸਰ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਸਰ ਹਾਂ ਠੀਕ ਐ ਸਰ ਠੀਕ ਐ ਸਰ ਚੰਗਾ ਸਰ ਠੀਕ ਐ ਠੀਕ ਐ ਸਰ ਮੈਂ ਸਰ ਜਲਦੀ ਆ ਜਾਵਾਂਗੀ ਛੇ ਕ ਵਜੇ ਆ ਜਾਵਾਂਗੀ ਤੇ ਮੈਂ ਬਾਕੀ ਕੰਮ ਕਰ ਲਾਗੀ ਕੋਈ ਗੱਲ ਨੀ ਸਰ ਆਜਾਗੀ ਠੀਕ ਆ ਸਰ ਠੀਕ ਐ ਸਰ ਚੰਗਾ ਸਰ ਚੰਗਾ ਹਾਂ ਚੰਗਾ ਸਰ ਓਕੇ ਸਰ ਓਕੇ ਸਰ ਓਕੇ ਸਰ ਸਤਿ ਸ਼੍ਰੀ ਅਕਾਲ ਸਰ